ਅਖਬਾਰਾਂ ਵਿੱਚ ਪਿੰਡਾਂ ਦੀਆਂ ਖਬਰਾਂ ਬਹੁਤ ਘੱਟ ਦਿਖਾਈਆਂ ਜਾਂਦੀਆਂ ਨੇ ਅਤੇ ਅਖਬਾਰਾਂ ਵਿੱਚ ਜਦੋਂ ਕੋਈ ਵਧੀਆ ਕੰਮ ਕਰਦਾ ਹੈ ਉਹ ਨਹੀਂ ਦਿਖਾਇਆ ਜਾਂਦਾ ਹੈਗਾ ਪਿੰਡਾਂ ਵਿਚ ਖਾਸ ਕਰਕੇ ਪਿੰਡਾਂ ਦੇ ਇਲਾਕਿਆਂ ਵਿੱਚ ਜਦੋਂ ਕੋਈ ਬੱਚਾ ਕੋਈ ਵਧੀਆ ਕੰਮ ਕਰਦਾ ਹੈ ਕੋਈ ਵਧੀਆ ਨੰਬਰ ਲੈ ਕੇ ਆਉਂਦਾ ਉਹ ਨਹੀਂ ਦਿਖਾਇਆ ਜਾਂਦਾ ਹੈਗਾ ਪਿੰਡਾਂ ਵਿੱਚ ਕੀ ਵਧੀਆ ਹੁੰਦਾ ਹੈ ਜਾਂ ਕੋਈ ਲਾਈਟਾਂ ਵਗੈਰਾ ਕੁਛ ਵੀ ਪਿੰਡਾਂ ਦੀਆਂ ਪੰਚਾਇਤਾਂ ਕੀ ਕੰਮ ਕਰਦੀਆਂ ਨੇ ਉਹ ਕੁਛ ਨਹੀਂ ਦਿਖਾਇਆ ਜਾਂਦਾ ਹੈ ਵਿਗਿਆਪਨ ਜ਼ਿਆਦਾਤਰ ਅਸ਼ਲੀਲ ਹੀ ਹੁੰਦੇ ਨੇ ਅਤੇ